ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਵੀਰ ਜੀ ਨਵਦੀਪ ਬੋਲ ਰਿਹਾ ਜੀ ਭਿਖੀ ਤੋਂ ਹਾਂ ਇੱਕ ਨਾ ਤੁਹਾਡੇ ਤੋਂ ਇਹ ਸਲਾਹ ਲੈਣੀ ਸੀ ਮੈਂ ਅਸੀਂ ਨਾ ਹੋਲੇ ਮਹੱਲੇ 'ਤੇ ਜਾਣ ਦੇ ਪਲਾਨ ਕਰ ਰਹੇ ਹਾਂ ਅਤੇ ਉਹਦੇ ਬਾਰੇ ਥੋੜ੍ਹੀ ਸਾਨੂੰ ਸਲਾਹ ਦਿਓ ਵੀ ਕਿਸ ਤਰ੍ਹਾਂ ਠੀਕ ਰਹੇਗਾ ਬਸ 'ਤੇ ਠੀਕ ਰਹੇ ਅਸੀਂ ਨਾ ਚਾਰ ਮੁੰਡੇ ਹਾਂ

ਨਾ ਨਾ ਥੋੜ੍ਹਾ ਇਹ ਪਤਾ ਗੱਡ ਅੱਛਾ ਜੀ ਅੱਛਾ ਜੀ ਅਤੇ ਉਹਦੇ ਹਾਂਜੀ ਹਾਂਜੀ ਨਹੀਂ ਮੈਂ ਥੋੜ੍ਹਾ ਇਹ ਪੁੱਛਣਾ ਸੀ ਵੀ ਕੋਈ ਜ਼ਿਆਦਾ ਰਸ਼ ਤਾਂ ਨਹੀਂ ਹੋਣਾ ਜਾਮ ਵਗੈਰਾ ਤਾਂ ਨਹੀਂ ਜੀ ਉਹਦੇ ਵਿੱਚ ਸਾਡਾ ਰਹਿਣ ਦਾ ਵੀ ਜੀ ਜੀ ਠੀਕ ਹੈ ਜੀ ਅੱਛਾ ਅੱਛਾ ਅਤੇ ਉਹਦਾ ਥੋੜ੍ਹਾ ਆਪਣਾ ਇਹਦੇ ਵਿੱਚ ਡਿਸਕਾਊਂਟ ਹੋ ਜਾਏਗਾ ਟੈਕਸੀ ਦਾ ਜਿਹੜਾ ਕਿਰਾਇਆ ਤੁਸੀਂ ਗੱਡੀ ਦਾ ਕਹਿ ਰਹੇ ਹੋ ਅੱਛਾ ਤਾਂ ਅਸੀਂ ਚਲੋ ਕਰਕੇ ਸਲਾਹ ਨਾ ਮੈਂ ਤੁਹਾਨੂੰ ਕੋਲ ਕਰੂੰਗਾ ਅਤੇ ਫਿਰ ਜਾ ਮਿਲ ਕੇ ਗੱਲ ਕਰ ਲਾਂਗੇ ਹਾਂ ਠੀਕ ਹੈ ਵੀਰ ਜੀ ਓ ਓਕੇ ਬਾਏ ਜੀ